ਪੰਜਾਬੀ ਸੱਭਿਆਚਾਰ ਵਿੱਚ ਜਿਵੇਂ ਕਿ ਭੰਗੜੇ ਦੀ ਬਹੁਤ ਹੀ ਪੁਰਾਤਨ ਪ੍ਰਥਾ ਹੈ ਇਹ ਸਾਡੇ ਸਿਆਣੇ ਬਿਆਣੇ ਬਜ਼ੁਰਗਾਂ ਆਪਣੇ ਮਤਲਬ ਕਿ ਬੜੇ ਵਡੇਰਿਆਂ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ ਇਹ ਮਤਲਬ ਕਿ ਕਿਸੇ ਵੀ ਖੁਸ਼ੀ ਦੇ ਮੌਕੇ 'ਤੇ ਜਿਵੇਂ ਕਿ ਕਿਸੇ ਖੁਸ਼ੀ ਦੇ ਮੌਕੇ 'ਤੇ ਜਿਸ ਦਾ ਜਿਵੇਂ ਕਿ ਘਰ ਵਿੱਚ ਕਿਸੇ ਦਾ ਵਿਆਹ ਹੋਣਾ ਠੀਕ ਹੈ ਜੀ ਉਹਦੇ ਬਾਅਦ ਘਰ ਵਿੱਚ ਕਿਸੇ ਦੇ ਜੰਮਣ 'ਤੇ ਘਰ ਵਿੱਚ ਕਿਸੇ ਹੋਰ ਖੁਸ਼ੀ ਦੇ ਮੌਕੇ 'ਤੇ ਵੀ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਵੀ ਬਹੁਤ ਪ੍ਰਕਾਰ ਦਾ ਹੈ ਜਿਵੇਂ ਕਿ ਲੁੱਡੀ ਹੁਲੜ ਛਾਈ ਬਹੁਤ ਹੀ ਤਰ੍ਹਾਂ ਦੇ ਭੰਗੜੇ ਅੱਜ ਦੇ ਸੱਭਿਆਚਾਰ ਵਿੱਚ ਹੁੰਦੇ ਹਨ ਜਿਵੇਂ ਕਿ ਇਹ ਮੇਨ ਪੰਜਾਬ ਦਾ ਇੱਕ ਮਤਲਬ ਕਿ ਪੰਜਾਬੀ ਸੱਭਿਆਚਾਰਕ ਭੰਗੜਾ ਉਹ ਹੈ ਨਾਚ ਹੈ ਠੀਕ ਹੈ ਜੀ ਦੂਜਾ ਅਤੇ ਆਪਣਾ ਇਹ ਹਿੱਸਾ ਮਹੱਤਵਪੂਰਨ ਇਸ ਲਈ ਬਣਿਆ ਕਿ ਇਸ ਇਹਨਾਂ ਦੇ ਪ੍ਰਤੀ ਸਾਡੇ ਸ ਸਨਮਾਨ ਵਿੱਚ ਜਾਗਰੂਕਤਾ ਫੈਲਾਉਣ ਲਈ ਇਹਨਾਂ ਦੇ ਮੈਚ ਕਰਵਾਏ ਜਾਣ ਲੱਗੇ ਹਰੇਕ ਸਕੂਲ ਕਾਲਜ ਵਿੱਚ ਇਹਨਾਂ ਦਾ ਹਰ ਤਰ੍ਹਾਂ ਦਾ ਇਹਨਾਂ ਦੇ ਮਤਲਬ ਕਿ ਜਿਸ ਨਾਲ ਇਹ ਆਪਣਾ ਸੱਭਿਆਚਾਰ ਇਹ ਅਗਾਂਹ ਅਗਾਂਹ ਹਰੇਕ ਪੀੜੀ ਦੇ ਮਨ ਵਿੱਚ ਬੈਠੇ ਤਾਂ ਕੰਪੀਟੀਸ਼ਨ ਹੋਣ ਲੱਗੇ ਜੀ ਮੁਕਾਬਲੇ ਹੋਣ ਲੱਗੇ ਮੁਕਾਬਲਿਆਂ ਦੇ ਦੇਖਦੇ ਹੋਏ ਇਨਾਮ ਰੱਖੇ ਜਾਣ ਲੱਗੇ ਮੁਕਾਬਲਿਆਂ ਦੇ ਨਾਲ ਨਾਲ ਇਹ ਦਿਮਾਗ ਮਤਲਬ ਕਿ ਜਿਹਨੂੰ ਜੇ ਭੰਗੜਾ ਨਹੀਂ ਪਸੰਦ ਤਾਂ ਉਹ ਮੁਕਾਬਲੇ ਮਤਲਬ ਕਿ ਇੱਕ ਤਰ੍ਹਾਂ ਚੈਲੇਂਜ ਸਮਝ ਕੇ ਇਹ ਭੰਗੜੇ ਵਿੱਚ ਇਹਨਾਂ ਨੂੰ ਹਿੱਸਾ ਲਿਆ ਇਹ ਅਗਾਂਹ ਅਗਾਂਹ ਜਿਵੇਂ ਆਪਣਾ ਅੱਜ ਕੱਲ੍ਹ ਔਨਲਾਈਨ ਦਾ ਜ਼ਮਾਨਾ ਹੈ ਜੀ ਔਨਲਾਈਨ ਜ਼ਮਾਨੇ ਨਾਲ ਵੀ ਬਹੁਤ ਭਾਰੀ ਚੀਜ਼ਾਂ ਜੋ ਵਾਇਰਲ ਪੋਪੂਲਰ ਹੋ ਜਾਂਦੀਆਂ ਨੇ ਜੀ ਇਸ ਨਾਲ ਇਹ ਵਾਇਰਲ ਹੋਇਆ ਅਤੇ ਭੰਗੜਾ ਸਾਡੀ ਪੰਜਾਬੀਆਂ ਦੀ ਸ਼ਾਨ ਹੈ